ਸਾਡੇ ਖੇਤਰ ਦੇ ਕਈ ਧਾਰਮਿਕ ਅਸਥਾਨ ਹੈਗੇ ਹੈ ਜਿੱਦਾਂ ਸ਼੍ਰੀ ਚਮਕੌਰ ਸਾਹਿਬ ਭੱਠਾ ਸਾਹਿਬ ਪਰ ਇਨ੍ਹਾਂ ਸਾਰਿਆਂ ਵਿੱਚੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ ਇਹ ਉਹ ਸਥਾਨ ਹੈ ਜਿੱਥੇ ਖਾਲਸੇ ਦੀ ਸਿਰਜਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵ ਵਿਸਾਖੀ ਦੇ ਦਿਹਾੜੇ ਸੰਨ ਸੋਲ੍ਹਾਂ ਸੌ ਨਿਆਨਵੇਂ ਵਿੱਚ ਕੀਤੀ ਸੀਗੀ ਇਸ ਸਥਾਨ 'ਤੇ ਰੋਜ਼ ਹਾਜ਼ਰੀ ਲਾਣੀ ਚਾਹੀਦੀ ਹੈ ਪਰ ਅਸੀਂ ਹਰ ਐਤਵਾਰ ਇਸ ਸਥਾਨ 'ਤੇ ਜਾਈਦਾ ਹੈ ਅਤੇ ਕੀਰਤਨ ਦਾ ਆਨੰਦ ਮਾਣਦੇ ਹੈ ਇੱਥੇ ਕਥਾ ਦੀ ਵਿਆਖਿਆ ਵੀ ਹੁੰਦੀ ਹੈ